ਹਾਂਜੀ ਜੇ ਗੱਲ ਗੱਲ ਕਰੀਏ ਤਾਂ ਨਦੀਆਂ ਦੀ ਤਾਂ ਨਦੀਆਂ ਦਾ ਸਾਡਾ ਪੰਜਾਬ ਦਾ ਨਾਮ ਹੀ ਪੰਜ ਆਬ ਪੰਜਾਬ ਜਾਣੀ ਕਿ ਪੰਜ ਇੱਥੇ ਦਰਿਆ ਵਗਦੇ ਹੁੰਦੇ ਸੀਗੇ ਪਰ ਹੁਣ ਜੋ ਸਾਡੀ ਸਰਕਾਰਾਂ ਨੇ ਜਦੋਂ ਵ ਵੰਡ ਹੋਈ ਸਾਡੇ ਦੇਸ਼ ਦੀ ਤਾਂ ਸਾਡੇ ਕੋਲੋਂ ਦੋ ਦੋ ਦਰਿਆ ਸਾਡੇ ਕੋਲੋਂ ਖੋਹ ਲਏ ਗਏ ਹੁਣ ਸਾਡੇ ਕੋਲ ਸਿਰਫ ਤਿੰਨ ਦਰਿਆ ਰਹਿ ਗਏ ਹਨ ਜੋ ਕਿ ਸਾਡੇ ਖੇਤੀਬਾੜੀ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵ ਰੱਖਦੇ ਹਨ ਸਾਨੂੰ ਉਹਨਾਂ ਤੇ ਬਹੁਤ ਜ਼ਿਆਦਾ ਪਾਣੀ ਖੇਤੀ ਲਈ ਮਿਲਦਾ ਹੈ ਕਈ ਖੇਤਰਾਂ ਦੇ ਵਿੱਚ ਤਾਂ ਉਹ ਉਹਨਾਂ ਦਾ ਪਾਣੀ ਪੀਣ ਦੇ ਯੋਗ ਵੀ ਲਈ ਵਰਤਿਆ ਜਾਂਦਾ ਹੈ ਇਸ ਕਰਕੇ ਸਾਨੂੰ ਨਦੀਆਂ ਨਾਲਿਆਂ ਦੇ ਵਿੱਚ ਕੋਈ ਵੀ ਕੂੜਾ ਕਰਕਟ ਨਹੀਂ ਸੁੱਟਣਾ ਚਾਹੀਦਾ ਅਸੀਂ ਕਈ ਵਾਰ ਦੇਖਦੇ ਹਾਂ ਜਦੋਂ ਟ੍ਰੇਨ ਆਪਣਾ ਆਪ ਨਦੀਆਂ ਦੇ ਉੱਪਰੋਂ ਲੰਘਦੀ ਹੈ ਜਾਂ ਬੱਸਾਂ ਦੇ ਪੁਲ਼ਾਂ ਦੇ ਉੱਪਰ ਨੂੰ ਸਵਾਰੀਆਂ ਲੰਘਦੀਆਂ ਤਾਂ ਉਹ ਰਸਤੇ ਵਿੱਚ ਜਾਂਦੇ ਜਾਂਦੇ ਕੋਈ ਨਾ ਕੋਈ ਗੰਦੀ ਚੀਜ਼ ਵਿੱਚ ਸੁੱਟ ਦਿੰਦੇ ਹਨ ਜੋ ਕਿ ਬਹੁਤ ਗਲਤ ਹੈ ਕਿਉਂਕਿ ਇਹ ਇਹ ਇੱਕ ਬਹੁਤ ਹੀ ਅਣਮੁੱਲਾ ਪਦਾਰਥ ਹੈ ਜੋ ਸਾਨੂੰ ਕੁਦਰਤ ਨੇ ਬਖਸ਼ਿਆ ਹੋਇਆ ਹੈ ਇਸ ਨੂੰ ਕਈ ਬੰਦੇ ਆਪਣੇ ਪੀਣ ਦੇ ਲਈ ਵੀ ਵਰਤਦੇ ਹਨ ਸੋ ਸਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ